ਹਾਂਜੀ ਮੈਂ ਹੁਣ ਗੱਲ ਕਰਨ ਜਾ ਰਿਹਾਂ ਮੈਂ ਪਿਛਲੇ ਸਮੇਂ ਵਿੱਚ ਇੱਕ ਲੈਪਟੋਪ ਮੰ ਮੰਗਵਾਇਆ ਸੀ ਉਸਦੇ ਬਾਰੇ ਅਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਲੈਪਟੋਪ ਜੋ ਮੈਂ ਮੰਗਵਾਇਆ ਸੀ ਇਹ ਮੇਰੇ ਲਈ ਕੁਛ ਖਾਸ ਫਾਇਦੇਮੰਦ ਨਹੀਂ ਰਿਹਾ ਬਲਕਿ ਇਸਨੇ ਮੈਨੂੰ ਬਹੁਤ ਜਿਆਦਾ ਨੁਕਸਾਨ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਲੈਪਟੋਪ ਮੈਂ ਆਪਣੇ ਜੋਬ ਜੋ ਮੈਂ ਜੋਬ ਕਰਦਾ ਹਾਂ ਉਸ ਲਈ ਮੰਗਵਾਇਆ ਸੀ ਮੈਂ ਸੋਚਿਆ ਸੀ ਕਿ ਇਹ ਮੇਰੇ ਟਾਇਮ ਦੀ ਵੀ ਬੱਚਤ ਕਰੇਗਾ ਅਤੇ ਜਿਵੇਂ ਮੈਂ ਇਸ ਦੇ ਬਾਰੇ ਪਤਾ ਕੀਤਾ ਸੀਗਾ ਵੀ ਇਹ ਬਹੁਤ ਹੀ ਵਧੀਆ ਇਹਦਾ ਬੈਟਰੀ ਪੈਕਅੱਪ ਹੈ ਸਾਰਾ ਕੁਛ ਹੈ ਉਹ ਉਸ ਹਿਸਾਬ ਨਾਲ ਇਸਦਾ ਪੈਕਅੱਪ ਬੈਟਰੀ ਪੈਕਅੱਪ ਅਤੇ ਹੋਰ ਕੁਛ ਵੀ ਵਧੀਆ ਨਹੀਂ ਨਿਕਲਿਆ ਇਸ ਦਾ ਸਕਰੀਨ ਵੀ ਹੋਰ ਲੈਪਟੋਪ ਜਿਵੇਂ ਆਪਾਂ ਦੇਖਦੇ ਹਾਂ ਮਾਰਕੀਟ ਵਿੱਚ ਉਹਨਾਂ ਨਾਲੋਂ ਵਧੀਆ ਕੁਆਲਿਟੀ ਦੀ ਨਹੀਂ ਸੀ ਇਸ ਦੀ ਕੁਆਲਿਟੀ ਵੀ ਕੁਛ ਖਾਸ ਨਹੀਂ ਸੀ ਅਤੇ ਇਹ ਹੋਰ ਵੀ ਬਹੁਤ ਸਾਰੇ ਫੀਚਰਾਂ ਦੀ ਕਮੀ ਸੀ ਇਸ ਵਿੱਚ ਜਿਵੇਂ ਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਬਹੁਤ ਸਾਰੇ ਨਵੇਂ ਨਵੇਂ ਫੀਚਰ ਆ ਚੁੱਕੇ ਹਨ ਪਰ ਇਸ ਲੈਪਟੋਪ ਵਿੱਚ ਨਾ ਤਾਂ ਫੀਚਰ ਸੀ ਨਾ ਇਸ ਵਿੱਚ ਕੋਈ ਖਾਸ ਬੈਟਰੀ ਪੈਕਅੱਪ ਸੀ ਅਤੇ ਕੁੱਲ ਮਿਲਾ ਕੇ ਮੈਨੂੰ ਇਸ ਵਿੱਚ ਕੁਛ ਐਡਾ ਖਾਸ ਨਹੀਂ ਲੱਗਿਆ ਸੋ ਮੈਂ ਇਸ ਤੋਂ ਨਰਾਜ਼ ਹਾਂ ਕਿ ਮੈਂ ਇਹ ਪ੍ਰੋਡਕਟ ਮੰਗਾ ਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਗਲਤ ਮਹਿਸੂਸ ਕਰ ਰਿਹਾ ਹਾਂ